ਠੀਕ ਹੈ ਜੀ ਵਧੀਆ ਹੋਰ ਤੁਸੀਂ ਦੱਸੋ ਹਾਂਜੀ ਹਾਂਜੀ ਸਾਰੇ ਠੀਕ ਨੇ ਤੁਸੀਂ ਦੱਸੋ ਹਾਂਜੀ ਬੱਚੇ ਠੀਕ ਆ ਵਧੀਆ ਹਾਂਜੀ ਲਾਉਣਾ ਹੈਗਾ ਬੱਚੇ ਨੂੰ ਸਕੂਲ ਹਾਂਜੀ ਮੈਂ ਪੁੱਛਣਾ ਸੀ ਤੁਹਾਨੂੰ ਮੈਂ ਕੌਲ ਹੀ ਕਰਨੀ ਸੀਗੀ ਅਤੇ ਤੁਸੀਂ ਕੌਲ ਕਰ ਲਈ ਮੈਂ ਪੁੱਛਣਾ ਸੀਗਾ ਬਈ ਸਕੂਲ ਪਾਉਣਾ ਸੀਗਾ ਬੱਚੇ ਨੂੰ ਤੁਹਾਡੇ ਬੱਚੇ ਕਿੱਥੇ ਪੜ੍ਹਦੇ ਆ ਬਈ ਸਕੂਲ ਕਿਹੜਾ ਸਹੀ ਰਹੇਗਾ ਬੱਚੇ ਲਈ ਮੁਕਤਸਰ 'ਚ ਹੀ ਹਾਂਜੀ ਹਾਂ ਹਾਂ ਹੂੰ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਬਾਕੀ ਅੱਠਵੀਂ ਤੱਕ ਤਾਂ ਫ਼੍ਰੀ ਹੋਵੇਗਾ ਹੈ ਨਾ ਬਈ ਮਤਲਬ ਕਿ ਵੀ ਖਾਣਾ ਵਗੈਰਾ ਤਾਂ ਦਿੰਦੇ ਹੀ ਹੋਣਗੇ ਸਰਕਾਰੀ ਸਕੂਲ 'ਚ ਅੱਛਾ ਹਾਂਜੀ ਵਜ਼ੀਫਾ ਵੀ ਦਿੰਦੇ ਹੋਣਗੇ ਹਾਂਜੀ ਮ ਕਿਉਂਕਿ ਹੁਣ ਨਾ ਸਰਕਾਰ ਬਦਲਣੇ ਕਰਕੇ ਬਈ ਥੋੜ੍ਹਾ ਜਿਹਾ ਵੀ ਵੱਧ ਹੋ ਗਿਆ ਵੀ ਸਰਕਾਰੀ ਸਕੂਲ ਹੈ ਜਿਹੜੇ ਹੈ ਨਾ ਵੀ ਬੱਚੇ ਪ੍ਰਾਈਵੇਟ ਸਕੂਲਾਂ 'ਚ ਪੰਜਾਬੀ ਜ਼ਿਆਦਾ ਨਹੀਂ ਬੋਲਦੇ ਸੀਗੇ ਬਈ ਮਤਲਬ ਕਿ ਹੁਣ ਪੰਜਾਬੀ ਨੂੰ ਜਾਗਰੂਕਤਾ ਕਰਕੇ ਵੀ ਪੰਜਾਬੀ ਜ਼ਿਆਦਾ ਬੋਲੀ ਜਾਂਦੀ ਹੈ ਹਾਂਜੀ ਬਾਕੀ ਸਰਕਾਰੀ ਸਕੂਲਾਂ ਦੇ ਵਿੱਚ ਖਾਣਾ ਵਧੀਆ ਦਿੰਦੇ ਹੈ ਹਾਂਜੀ ਪਹਿਨਣ ਨੂੰ ਕੱਪੜੇ ਵਰਦੀਆਂ ਵਗੈਰਾ ਵੀ ਵਧੀਆ ਦਿੰਦੇ ਹੈ ਹਾਂਜੀ ਅਤੇ ਪੰਜਾਬੀ ਵਧੀਆ ਪੜ੍ਹਾਈ ਜਾਂਦੀ ਆ ਟੀਚਰ ਵਧੀਆ ਪੜ੍ਹਾਉਂਦੇ ਬੱਚਿਆਂ ਨੂੰ ਹਾਂਜੀ ਹਾਂਜੀ ਹਾਂਜੀ ਅਨੁਸ਼ਾਸਨ ਵਿੱਚ ਵਧੀਆ ਰੱਖਦੇ ਬੱਚਿਆਂ ਨੂੰ ਬਈ ਜਿਓਂ ਬਈ ਕੋਈ ਦਿੱਕਤ ਵਾਲੀ ਕੋਈ ਪ੍ਰੋਬਲਮ ਵਾਲੀ ਗੱਲ ਤਾਂ ਨਹੀਂ ਅੱਛਾ ਜੀ ਬਸ ਜੀ ਮੈਂ ਹਾਂਜੀ ਥੈਂਕ ਯੂ ਧੰਨਵਾਦ ਤੁਹਾਡਾ ਬਹੁਤ ਮੈਂ ਇਹੀ ਪੁੱਛਣਾ ਸੀ ਠੀਕ ਹੈ